ਇੱਕ ਜਨਵਰੀ ਦੋ ਹਜ਼ਾਰ ਵੀਹ ਦੋ ਫਰਵਰੀ ਦੋ ਹਜ਼ਾਰ ਇੱਕੀ ਤਿੰਨ ਮਾਰਚ ਦੋ ਹਜ਼ਾਰ ਬਾਈ ਚਾਰ ਅਪ੍ਰੈਲ ਦੋ ਹਜ਼ਾਰ ਤੇਈ ਪੰਜ ਮਈ ਦੋ ਹਜ਼ਾਰ ਤੇਈ